ਮੈਂ ਖਾਣਾ ਬਚਪਨ ਤੋਂ ਹੀ ਬੜੇ ਸ਼ੌਂਕ ਨਾਲ ਬਣਾਉਂਦੀ ਹਾਂ ਮੇਰਾ ਭੋਜਨ ਸਭ ਨੂੰ ਪਸੰਦ ਆਉਂਦਾ ਹੈ ਮੈਂ ਆਪਣੀ ਦਾਦੀ ਜੀ ਤੋਂ ਕੁਝ ਮਸਾਲਿਆਂ ਬਾਰੇ ਸੁਣਿਆ ਸੀ ਉਹ ਮਸਾਲੇ ਹੀ ਮੇਰੇ ਖਾਣੇ ਨੂੰ ਸੁਆਦ ਬਣਾਉਂਦੇ ਹਨ ਜਿਵੇਂ ਕਿ ਗਰਮ ਮਸਾਲਾ ਇਹ ਅਸੀਂ ਆਪਣੇ ਘਰ ਵਿੱਚ ਹੀ ਤਿਆਰ ਕਰਦੇ ਹਾਂ ਕੜ੍ਹੀ ਪੱਤਾ ਤੇਜ ਪੱਤਾ ਰਾਈ ਕਸਤੂਰੀ ਮੇਥੀ ਹਿੰਗ ਐਮ ਡੀ ਐਚ ਮਸਾਲੇ ਵੀ ਹਨ ਜੋ ਭੋਜਨ ਵਿੱਚ ਅਲੱਗ ਹੀ ਸੁਆਦ ਲਿਆਉਂਦੇ ਹਨ ਕੁਝ ਭੋਜਨ ਨੂੰ ਪਕਾਉਣ ਦੀਆਂ ਵਿਧੀਆਂ ਵੀ ਹੁੰਦੀਆਂ ਹਨ ਜ਼ਿਆਦਾ ਧਿਆਨ ਨਾ ਦਿੱਤਾ ਜਾਵੇ ਤਾਂ ਭੋਜਨ ਖਰਾਬ ਭੋਜਨ ਵਿੱਚ ਖਰਾਬੀ ਆ ਜਾਂਦੀ ਹੈ ਜਾਂ ਭੋਜਨ ਬੇਸੁਆਦ ਹੁੰਦਾ ਹੈ ਹਰ ਇੱਕ ਭੋਜਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੈ ਜਿਵੇਂ ਫਾਸਟ ਫੂਡ ਦੀ ਗੱਲ ਕਰੀਏ ਤਾਂ ਉਹ ਸਿਰਕਾ ਅਲਾ ਰੋਟ ਮਿੱਠਾ ਸੋਡਾ ਚਟਨੀਆਂ ਸੋਇਆ ਸੋਸ ਚਿੱਲੀ ਫਲੈਕਸ ਓਗੈਨੋ ਮਿਓਨੀ ਜੀਰਾ ਅਜਵਾਇਨ ਸੁੰਢ ਹੋਰ ਮਸਾਲੇ ਵੀ ਹਨ ਜੋ ਜੋ ਭੋਜਨ ਨੂੰ ਸੁਆਦ ਬਣਾਉਂਦੇ ਹਨ ਧੰਨਵਾਦ